ਦੁਨੀਆ ਵਿੱਚ ਸਭ ਤੋਂ ਬੈਸਟ ਭੋਜਨ ਭਾਰਤ ਦਾ ਏ ਜਿਵੇਂ ਕਿ ਕੜੀ ਚਾਵਲ ਰਾਜਮਾਂਹ ਚਾਵਲ ਛੋਲੇ ਚਾਵਲ ਇਹ ਲੋਕ ਤਾਂ ਖਾਣ 'ਚ ਬਹੁਤ ਹੀ ਸ਼ੌਕੀਨ ਹੈਗੇ ਆ ਬਸ ਜਿੱਥੇ ਕੜੀ ਚਾਵਲ ਰਾਜਮਾਂਹ ਚਾਵਲ ਬਣੇ ਹੋਣ ਬਸ ਟੁੱਟ ਹੀ ਪਓ ਉੱਥੇ ਤਾਂ ਬਸ ਲੱਗ ਹੀ ਜਾਓ ਔਰ ਪਿੱਛੇ ਹੀ ਲੱਗ ਜਾਓ ਭਾਵੇਂ ਕਿਤੇ ਲੱਗਾ ਲੰਗਰ ਲੱਗਾ ਹੋਵੇ ਉਹਦੇ ਪਿੱਛੇ ਪਿੱਛੇ ਬਸ ਲਾਈਨਾਂ ਦੇ ਪਿੱਛੇ ਲੱਗ ਜਾਓ ਰੋਜ਼ਾਨਾ ਜੀਵਨ ਵਿੱਚ ਬੜੇ ਤਰ੍ਹਾਂ ਦੇ ਭੋਜਨ ਬਣਾਏ ਜਾਂਦੇ ਹਨ ਪਰ ਕਈ ਲੋਕਾਂ ਨੂੰ ਹਰ ਇੱਕ ਦੀ ਚੋਇਸ ਅਲੱਗ ਅਲੱਗ ਹੈ ਹਰ ਇੱਕ ਅਲੱਗ ਅਲੱਗ ਅਲੱਗ ਤਰ੍ਹਾਂ ਦਾ ਖਾਣਾ ਖਾਂਦੇ ਆ ਪਰ ਜਿਵੇਂ ਕਿ ਸਾਡੇ ਵਰਗੇ ਪੰਜਾਬੀ ਲੋਕ ਆ ਉਹ ਤਾਂ ਰਾਜਮਾਂਹ ਚਾਵਲ ਕੜੀ ਚਾਵਲ ਦੇ ਬਹੁਤ ਜ਼ਿਆਦਾ ਜਿਵੇਂ ਸ਼ੌਕੀਨ ਹੀ ਹੈ ਕਿ ਬਸ ਕਿ ਸਾਨੂੰ ਇਹ ਚੀਜ਼ਾਂ ਮਿਲ ਜਾਣ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਹੈਗੇ ਹੀ ਆ ਮਸਾਲੇਦਾਰ ਪਕਵਾਨ ਵੀ ਹੈ ਜਿਵੇਂ ਡੋਸਾ ਬਰਗਰ ਪੀਜ਼ਾ ਬਹੁਤ ਜ਼ਿਆਦਾ ਪਕਵਾਨ ਹੈ ਮਸਾਲੇਦਾਰ ਇਹਦੇ ਵਿੱਚ ਕਈ ਤਰ੍ਹਾਂ ਦੇ ਮਸਾਲੇ ਪਾਏ ਜਾਂਦੇ ਹੈ ਬਹੁਤ ਜ਼ਿਆਦਾ ਇਹ ਸਾਡੇ ਲਈ ਨੁਕਸਾਨਦਾਇਕ ਵੀ ਹੈਗੇ ਆ ਪਰ ਮੂੰਹ ਦੇ ਟੇਸਟ ਲਈ ਤਾਂ ਬਹੁਤ ਜ਼ਿਆਦਾ ਵਧੀਆ ਹੈਗੇ ਆ ਭਾਰਤ ਦਾ ਭੋਜਨ ਤਾਂ ਸਭ ਤੋਂ ਵਧੀਆ ਹੈਗਾ ਵਾ ਭਾਰਤ ਦੀਆਂ ਸਬਜ਼ੀਆਂ ਵੀ ਬਹੁਤ ਵਧੀਆਂ ਹੈਗੀਆਂ ਫ਼ਸਲਾਂ ਵੀ ਬਹੁਤ ਵਧੀਆਂ ਹੈਗੀਆਂ ਵਾ ਬਾਹਰ ਵਰਗੇ ਸ਼ਹਿਰਾਂ ਨਾਲ਼ੋਂ ਤਾਂ ਇੱਥੋਂ ਦੀ ਉਪਜਾਊ ਮਿੱਟੀ ਬੜੀ ਵਧੀਆ ਹੈਗੀ ਆ ਜਿਹਦੇ ਵਿੱਚ ਸਬਜ਼ੀਆਂ ਉੱਗਦੀਆਂ ਵਾ ਉਹ ਸਾਡੇ ਲਈ ਬਹੁਤ ਜਿਵੇਂ ਹਰੀਆਂ ਸਬਜ਼ੀਆਂ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਪ੍ਰਫੂੱਲਿਤ ਹੈਗੀਆ ਵਾ ਸਾਡੇ ਸਰੀਰ ਨੂੰ ਵੀ ਚੰਗਾ ਰੱਖਦੀਆਂ ਵਾ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਪਰ ਅੱਜ ਕੱਲ੍ਹ ਦੇ ਲੋਕ ਹਰੀਆਂ ਸਬਜ਼ੀਆਂ ਖਾਂਦੇ ਨਹੀਂ ਚਾਈਨੀਜ਼ ਭੋਜਨ ਦੇ ਪਿੱਛੇ ਲੱਗੇ ਰਹਿੰਦੇ ਆ ਚਲੋ ਉਹ ਵੀ ਖਾਓ ਕਦੇ ਕਦਾਈ ਕਦੇ ਕਦਾਏ ਖਾਣੀਆਂ ਚਾਹੀਦੀਆਂ ਹਨ ਪਰ ਜਿਹੜਾ ਭਾਰਤ ਦਾ ਮੇਨ ਭੋਜਨ ਹੈ ਉਹ ਤਾਂ ਸਾਨੂੰ ਖਾਣਾ ਹੀ ਚਾਹੀਦਾ ਉਹ ਤਾਂ ਸਾਡੇ ਲਈ ਬਹੁਤ ਜਿਵੇਂ ਜ਼ਰੂਰੀ ਹੈ ਸਬਜ਼ੀਆਂ ਬਹੁਤ ਜ਼ਰੂਰੀ ਹੈ ਹੋਰ ਜਿਵੇਂ ਅੱਜ ਕੱਲ੍ਹ ਕਣਕ ਮੱਕੀ ਇਹੋ ਜਿਹੀਆਂ ਚੀਜ਼ਾਂ ਚਲੋ ਖਾਣੀਆਂ ਚਾਹੀਦੀਆਂ ਸਭ ਕੁਛ ਖਾਣਾ ਚਾਹੀਦਾ ਜੋ ਦੁਨੀਆਂ 'ਚ ਹੈਗਾ ਉਹਨੂੰ ਤਾਂ ਖਾਣਾ ਹੀ ਖਾਣਾ ਭਾਰਤ ਦਾ ਹੋਰ ਵੀ ਜਿਵੇਂ ਭੋਜਨ ਹੈ ਮਾਸ ਮੱਛੀ ਵਗੈਰਾ ਵੀ ਕਈ ਲੋਕ ਖਾਂਦੇ ਹੈ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੈ ਜੀ ਜੋ ਖਾਣਾ ਚਾਹੁੰਦਾ ਸੋ ਖਾਵੇ ਜੋ ਨਹੀਂ ਖਾਣਾ ਚਾਹੁੰਦਾ ਸੋ ਨਾ ਖਾਵੇ ਭਾਰਤ ਵਿੱਚ ਕਾਫ਼ੀ ਤਰ੍ਹਾਂ ਦੇ ਭੋਜਨ ਆ ਹੈਗੇ ਆ ਹਰ ਇੱਕ ਦਾ ਆਪਣਾ ਆਪਣਾ ਟੇਸਟ ਮਸਾਲੇ ਭਾਰਤ ਵਿੱਚ ਬਹੁਤ ਜ਼ਿਆਦਾ ਹਲਦੀ ਮਿਰਚ ਗਰਮ ਮਸਾਲਾ ਕਾਲੀ ਮ ਕਾਲੀ ਮਿਰਚ ਉਹ ਸੁੱਕਾ ਧਨੀਆ ਹੋਰ ਲੋਂਗ ਲਾਚੀ ਮਸਾਲੇ ਵੀ ਬਹੁਤ ਪ੍ਰਫੁੱਲਤ ਹੈਗੇ ਆ